ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਸੋਫ਼ਾ ਵੀ ਰਿਨਿਊ ਕਰਵਾਉਣਾ ਹੈ ਅੱਛਾ ਠੀਕ ਹੈ ਉਹਦੀ ਗੱਦੀਆਂ ਗੁੱਦੀਆਂ ਚੇਂਜ ਤੁਸੀਂ ਤੁਸੀਂ ਪੁਰਾਣਾ ਕਿਉਂ ਹੀ ਲੈਣਾ ਨਵਾਂ ਲੈ ਲਓ ਇਹਦੇ ਨਾਲੋਂ ਹਾਂਜੀ ਹਾਂਜੀ ਹੂੰ ਠੀਕ ਠੀਕ ਹੈ ਜੀ ਅਤੇ ਤੁਸੀਂ ਇਹ ਇਹਦਾ ਖ਼ਰਚਾ ਥੋੜ੍ਹਾ ਜ਼ਿਆਦਾ ਪੈ ਜਾਣਾ ਜੀ ਤੁਸੀਂ ਤੁਸੀਂ ਦੇਖ ਲਓ ਤੁਹਾਡੇ ਕੋਲ ਜਗ੍ਹਾ ਹੈਗੀ ਤਾਂ ਅਸੀਂ ਤੁਹਾਡੇ ਕੋਲ ਕਰ ਲਵਾਂਗੇ ਜੇ ਨਹੀਂ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਤਾਂ ਫਿਰ ਅਸੀਂ ਫਿਰ ਆਪਣੇ ਬੰਦੇ ਭੇਜ ਦੇਵਾਂਗੇ ਉੱਥੇ ਫਿਰ ਉਹ ਥੋੜ੍ਹਾ ਕੁ ਟਾਈਮ ਲੱਗੂਗਾ ਕਿਉਂਕਿ ਉਹਨੂੰ ਸਾਰਾ ਕੁਛ ਕੱਢ ਕੇ ਦੁਬਾਰਾ ਸਾਰੀ ਸਨਮਾਇਕਾ ਨਿਕਾਲ ਕੇ ਫਿਰ ਦੁਬਾਰਾ ਕਰਨਾ ਪੈਣਾ ਨਾ ਸਾਰਾ ਕੁਛ ਅਤੇ ਫਿਰ ਸਮਾਨ ਸਮਾਨ ਵੀ ਤੁਸੀਂ ਦੇਖੋ ਤੁਸੀਂ ਕਿੱਦਾਂ ਤੁਸੀਂ ਦੇਖੋ ਤੁਹਾਨੂੰ ਜਿੱਦਾਂ ਕੰਫਰਟੇਬਲ ਲੱਗਦਾ ਹੈ

ਠੀਕ ਹਾਂਜੀ ਉਹ ਸਨਮਾਇਕਾ ਤੁਸੀਂ ਆਪਣਾ ਪਸੰਦ ਕਰ ਲਿਓ ਕਿਸ ਤਰ੍ਹਾਂ ਦਾ ਸਨਮਾਇਕਾ ਤੁਹਾਨੂੰ ਚਾਹੀਦਾ ਇਆ ਅਤੇ ਗੱਦੀਆਂ ਵੀ ਜਿਹੜੇ ਸੋਫ਼ੇ ਦੇ ਗੱਦੇ ਹੈ ਕੱਪੜਾ ਹੋ ਗਿਆ ਉਹਦਾ ਉਹ ਵੀ ਆਪਣਾ ਅੱਜ ਕੱਲ੍ਹ ਦੇ ਸਟਾਈਲ 'ਚ ਪਏ ਹੈ ਉਹ ਵੀ ਦੇਖ ਲਿਓ ਤੁਸੀਂ ਆ ਕੇ ਅਤੇ ਆਪਣਾ ਸਾਰਾ ਕੁਛ ਸਿਲੈਕਟ ਕਰ ਲਿਓ ਫਿਰ ਮੈਨੂੰ ਦੱਸ ਦਿਓ ਕਦੋਂ ਤੋਂ ਕੰਮ ਸ਼ੁਰੂ ਕਰਨਾ ਅਸੀਂ ਫਿਰ ਆਪਣੇ ਬੰਦੇ ਭੇਜ ਕੇ ਹੂੰ ਬਸ ਉਹਦਾ ਖ਼ਰਚਾ ਥੋੜ੍ਹਾ ਜ਼ਿਆਦਾ ਹਾਂਜੀ ਹਾਂਜੀ ਹਾਂਜੀ ਉਹ ਤਾਂ ਦੇਖੋ ਜੀ ਸੋ ਇਹ ਚੀਜ਼ਾਂ ਥੋੜ੍ਹੀਆਂ ਮਹਿੰਗੀਆਂ ਪੈ ਜਾਂਦੀਆਂ ਕਿਉਂਕਿ ਸਾਰਾ ਦੁਆਰਾ ਕੱਢ ਕੇ ਖੋਲ੍ਹ ਕੇ ਅਤੇ ਫਿਰ ਦੁਬਾਰਾ ਸਨਮਾਇਕਾ ਲੱਗਣਾ ਅਤੇ ਉਹ ਦਾ ਠਾ ਤੁਹਾਨੂੰ ਡਬਲ ਕੰਮ ਪੈ ਜਾਂਦਾ ਨਾ ਲਗਾਉਣਾ ਹੀ ਨਹੀਂ ਨਾ ਕੱਢਣਾ ਵੀ ਹੈਗਾ ਹੈ ਅਤੇ ਹਾਂਜੀ ਫਿਰ ਇਹਦਾ ਖਰਚਾ ਫਿਰ ਆਪਾਂ ਚੀਜ਼ ਦੇਖ ਕੇ ਦੱਸਾਂਗੇ ਵੀ ਕਿਸ ਤਰ੍ਹਾਂ ਦਾ ਚੀਜ਼ ਹੈ ਕਿਸ ਤਰ੍ਹਾਂ ਦੀ ਨਹੀਂ ਹੈ ਕਿੰਨਾ ਕੁ ਟਾਈਮ ਲੱਗਣਾ ਹੈ ਔਰ ਕਿੰਨੀ ਕੁ ਮਿਹਨਤ ਹੈ ਹੈ ਨਾ ਉਹ ਚੀਜ਼ ਦੇਖ ਕੇ ਫਿਰ ਅਸੀਂ ਦੱਸਾਂਗੇ ਤੁਹਾਨੂੰ ਅੱਛਾ ਜੀ ਫਿਕਸ ਕਰਵਾਉਣਾ ਹੈ ਹਾਂਜੀ ਹਾਂਜੀ ਕੋਈ ਹੂੰ ਹੂੰ ਹਾਂਜੀ ਠੀਕ ਹੈ ਕੋਈ ਨਾ ਪੋਲਿਸ਼ ਪੁਲਿਸ਼ ਕਰਕੇ ਹੈ ਨਾ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਆਪਣਾ ਐਡਰੈੱਸ ਦੱਸ ਦਿਓ ਅਤੇ ਆਪਣਾ ਸਾਡੇ ਬੰਦੇ ਉੱਥੇ ਆ ਜਾਣਗੇ ਪਹਿਲੇ ਤੁਸੀਂ ਆ ਜਿਓ ਸਾਡੇ ਨਾ ਦੁਕਾਨ 'ਤੇ ਤੁਸੀਂ ਸਾਡੇ ਜੀ ਸੁਹਾਣੀ ਬਿਲਡਿੰਗ ਹਾਂ ਹਾਂਜੀ ਹਾਂਜੀ ਤਾਹੀਂ ਤੁਸੀਂ ਆਪਣਾ ਐਂ ਕਰਿਓ ਆ ਜਿਓ ਸ਼ੋਪ 'ਤੇ ਆਪਣਾ ਸਮਾਨ ਦੇਖ ਲਿਓ ਕਿੱਦਾਂ ਦਾ ਤੁਹਾਨੂੰ ਚਾਹੀਦਾ ਹੈ ਕਿੱਦਾਂ ਸਿਲੈਕਟ ਕਰ ਲਿਓ ਫਿਰ ਆਪਣਾ ਅਸੀਂ ਬੰਦੇ ਤੁਹਾਡੇ ਨਾਲ ਹੀ ਭੇਜ ਦਾਂਗੇ ਤੁਹਾਡਾ ਘਰ ਵੀ ਦੇਖ ਆਉਣਗੇ ਨਾਲੇ ਤੁਹਾਡਾ ਸਮਾਨ ਵੀ ਦੇਖ ਆਉਣਗੇ ਵੀ ਕਿੱਦਾਂ ਦਾ ਤੁਹਾਡਾ ਸਮਾਨ ਹੈ ਹੈ ਨਾ ਹਾਂਜੀ ਕਵਿਤਾ ਦੇ ਨਾਮ 'ਤੇ ਸ਼ੋਪ ਹੈ ਹਾਂਜੀ ਸਵੇਰੇ ਦਸ ਵਜੇ ਖੁੱਲ੍ਹ ਜਾਂਦੀ ਹੈ ਰਾਤ ਦੇ ਦਸ ਵਜੇ ਤੱਕ ਜਦੋਂ ਮਰਜੀ ਤੁਸੀਂ ਆਓ ਹਾਂਜੀ ਚਲੋ ਠੀਕ ਹੈ ਜੀ